ਹੈਲੋ ਆਂਟੀ ਤੁਸੀਂ ਨਾਗਪਲ ਸ਼ੋਪ ਤੋਂ ਬੋਲਦੇ ਹੋ ਮੈਂ ਤੁਹਾਡੇ ਤੋਂ ਹੇਅ ਰਰ ਆਰਡਰ ਦਿੱਤਾ ਸੀਗਾ ਅਤੇ ਓ ਉਹ ਵਰਤਣ ਨਾਲ ਆਂਟੀ ਜੀ ਮੇਰੇ ਵਾਲ ਇੰਨੇ ਖਰਾਬ ਹੋ ਗਏ ਰੂਡਲੀ ਹੋ ਗਏ ਸਿੱਕਰੀ ਪੈ ਗਈ ਸਿਰ ਵਿੱਚ ਨਾਲੇ ਵਾਲ ਝੜਨ ਲੱਗ ਪਏ ਹੁਣ ਤੁਹਾਡਾ ਪ੍ਰੋਡਕਟ ਐਡਾ ਗੰਦਾ ਨਿਕਲਿਆ ਆਂਟੀ ਜੀ ਹੁਣ ਦੱਸੋ ਮੈਂ ਹੁਣ ਤੁਹਾਡੇ ਤੋਂ ਕੀ ਸਮਾਨ ਲਵਾਂ ਨਾਲੇ ਤੁਹਾਨੂੰ ਮੈਂ ਪੈਸੇ ਵੀ ਪੂਰੇ ਦਿੱਤੇ ਜਿੰਨੇ ਤੁਸੀਂ ਮੰਗੇ ਮੈਂ ਉੰਨੇ ਦਿੱਤੇ ਪੈਸਿਆਂ ਦਾ ਵੀ ਨਹੀਂ ਘੱਟ ਵਾਧਾ ਕੀਤਾ ਹੁਣ ਦੱਸੋ ਮੈਂ ਕੀ ਕਰਾਂ ਮੈਂ ਹੁਣ ਹੋਰ ਕਸਟਮਰ ਭੇਜਣੇ ਸੀ ਮੇਰੇ ਕਸਟਮਰ ਹੁਣ ਕੀ ਆਉਣਗੇ ਤੁਹਾਡੇ ਕੋਲ ਦੱਸੋ ਮੈਂ ਤੁਹਾਡੇ ਤੋਂ ਅੱਗੇ ਤੋਂ ਕੋਈ ਸਮਾਨ ਨਹੀਂ ਲੈਣਾ ਆਂਟੀ ਜੀ ਬਸ ਹੁਣ ਮੇਰੇ ਤਾਂ ਸਾਰੇ ਵਾਲ ਖਰਾਬ ਹੋ ਗਏ ਤੁਹਾਡੇ ਪ੍ਰੈ ਪ੍ਰੋਡਕਟ ਯੂਜ ਕਰਨ ਨਾਲ ਹੁਣ ਦੱਸੋ ਮੇਰੇ ਪੈਸੇ ਤੁਸੀਂ ਜਾਂ ਤਾਂ ਵਾਪਿਸ ਕਰੋ ਆਂਟੀ ਜੀ ਅਤੇ ਜਾਂ ਮੈਨੂੰ ਕੋਈ ਦੱਸੋ ਹੱਲ ਦੱਸੋ ਵੀ ਮੈਂ ਹੁਣ ਅੱਜ ਇਸ ਵਾਲਾਂ ਦਾ ਕੀ ਕਰਾਂ ਮੇਰੇ ਤਾਂ ਸਾਰੇ ਵਾਲ ਖਰਾਬ ਹੋ ਗਏ